ਮੈਂ ਹਜੇ ਤੱਕ ਕੁਝ ਕਾਨੂੰਨੀ ਦਸਤਾਵੇਜ਼ ਹੀ ਬਣਾਏ ਹਨ ਜਿਵੇਂ ਕਿ ਆਧਾਰ ਕਾਰਡ ਪਾਸਪੋਰਟ ਅਤੇ ਡਰਾਈਵਿੰਗ ਲਾਈਸੈਂਸ ਮੈਨੂੰ ਹਜੇ ਤੱਕ ਇੱਦਾਂ ਦੀ ਕੋਈ ਮੁਸ਼ਕਿਲ ਨਹੀਂ ਆਈ ਪਰ ਜਿਹੜੇ ਕਾਨੂੰਨੀ ਦਸਤਾਵੇਜ਼ ਬਣਨ ਵਾਸਤੇ ਟਾਈਮ ਲੱਗਦਾ ਹੈ ਉਹ ਬਹੁਤ ਲੰਬਾ ਹੁੰਦਾ ਹੈ ਅਤੇ ਕਦੇ ਕ ਵਾਰੀ ਤੁਹਾਨੂੰ ਜਿਹੜਾ ਵੀ ਤੁਹਾਡਾ ਜਿ ਜਿਵੇਂ ਕਿ ਆਧਾਰ ਕਾਰਡ ਹੈਜੇ ਤੁਹਾਨੂੰ ਕਈ ਕਈ ਵਾਰੀ ਤੁਹਾਨੂੰ ਆਧਾਰ ਕਾਰਡ ਦੀ ਲੋੜ ਪੈ ਜਾਂਦੀ ਹੈ ਬਟ ਕਿਉਂਕਿ ਹਜੇ ਤੱਕ ਉਹ ਬਣਿਆ ਨਹੀਂ ਹੋਇਆ ਅਤੇ ਉਹਨੂੰ ਟਾਈਮ ਲੱਗੂਗਾ ਆਉਣ ਨੂੰ ਤੋ ਤਾਂ ਉਸ ਕਰ ਕੇ ਤੁਹਾਨੂੰ ਉਨੀ ਦੇਰ ਵੇਟ ਕਰਨਾ ਪੈਂਦਾ ਹੈ ਜਿਸ ਕਰਕੇ ਕਈ ਵਾਰੀ ਤੁਹਾਡੇ ਕੰਮ ਵਿੱਚ ਅਟਕ ਜਾਂਦੇ ਹਨ ਅਤੇ ਉਹ ਕੰਪਲੀਟ ਨਹੀਂ ਹੋ ਪਾਉਂਦੇ